ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਨਾ ਜਿੱਦਾਂ ਹੁਣ ਹੁਣੀ ਛੱਬੀ ਜਨਵਰੀ ਨਿਕਲੀ ਹੈ ਅਤੇ ਉਦੋਂ ਆਪਾਂ ਆਪਣਾ ਗਣਤੰਤਰ ਦਿਵਸ ਮਨਾਇਆ ਸੀਗਾ ਅਤੇ ਹੁਣ ਜਿੱਦਾਂ ਆਪਾਂ ਆਪਾਂ ਇੰਡੀਪੈਂਡੈਂਸ ਡੇ ਮਨਾਉਂਦੇ ਹੈਗੇ ਹਾਂ ਹੁਣ ਅਤੇ ਉਹਦੇ ਰਿਲੇਟਡ ਪੰਜਾਬ ਦੇ ਜਿਹੜੇ ਮੇਨ ਫਰੀਡਮ ਫਾਈਟਰ ਸੀਗੇ ਜਿਵੇਂ ਕਿ ਹੋ ਗਏ ਭਗਤ ਸਿੰਘ ਹੋ ਗਏ ਸਰਦਾਰ ਊਧਮ ਸਿੰਘ ਰਾਜਗੁਰੂ ਲਾਲਾ ਲਾਜਪਤ ਰਾਏ ਅਤੇ ਇਹਨਾਂ ਬਾਰੇ ਕੁਛ ਹਿਸਟੋਰੀਕਲ ਸਿਗਨੀਫਿਕੈਂਸ ਵਾਲੀ ਗੱਲਾਂ ਕੁਛ ਦੱਸ ਸਕਦੇ ਹੋ ਕਿ ਕਿਵੇਂ ਹਾਂਜੀ ਇਹ ਭਗਤ ਸਿੰਘ ਦਾ ਮੇਨ ਜਿਹੜਾ ਅਸੈਂਬਲੀ ਵਿੱਚ ਬੰਬ ਸੁੱਟਿਆ ਸੀਗਾ ਅਤੇ ਜਦੋਂ ਜ਼ਲ੍ਹਿਆਂਵਾਲੇ ਬਾਗ ਦਾ ਜਿਹੜਾ ਕਤਲਕਾਂਡ ਹੋਇਆ ਸੀਗਾ ਅਤੇ ਉਹਦਾ ਜਿਹੜਾ ਮੇਨ ਬੰਦਾ ਸੀ ਜਨਰਲ ਡਾਇਰ ਇਹ ਨਾ ਉਹਦੀ ਮੌਤ ਦਾ ਬਦਲਾ ਲਿਆ ਅਤੇ ਦੱਸੋ ਹਾਂਜੀ ਆਪਣੇ ਵਾਲ ਵਾਲ ਕਟਵਾ 'ਤੇ ਸੀਗੇ ਨਾਰੇ ਨਾਅਰੇ ਲਗਾ ਕੇ ਅਤੇ ਖੜ੍ਹੇ ਹੋ ਗਏ ਸੀਗੇ ਇਸ ਤੋਂ ਪਹਿਲਾਂ ਹੀ ਉਸੀ ਟਾਈਮ ਹੀ

ਉਹਨਾਂ ਦੀ ਵੀ ਡੈਥ ਉਹਨਾਂ ਦੀ ਵੀ ਡੈਥ ਕਾਫੀ ਦਰਦਨਾਕ ਸੀਗੀ ਜਦੋਂ ਉੱਥੇ ਲਾਠੀਚਾਰਜ ਹੋ ਗਿਆ ਸੀ ਅਤੇ ਇਹਨਾਂ ਨੇ ਕਿਹਾ ਸੀ ਕਿ ਬਜ਼ੁਰਗਾਂ ਦੇ ਉੱਤੇ ਲਾਠੀ ਨਹੀਂ ਬਰਸਾਉਣੀ ਆ ਅਤੇ ਜਿੱਦਾਂ ਉਹਨਾਂ ਦੇ ਸਿਰ 'ਤੇ ਲੱਗੀ ਸੀ ਤਾਂ ਕਰਕੇ ਉਹਦੀ ਉੱਥੇ ਹੀ ਡੈਥ ਹੋ ਗਈ ਸੀ ਹਾਂਜੀ ਕਾਫੀ ਹਾਂਜੀ ਹਾਂਜੀ ਜੀ ਹਾਂਜੀ ਮੈਮ ਓਕੇ ਮੈਮ ਥੈਂਕ ਯੂ